ਅਸੀਂ ਅੱਜ ਕੱਲ੍ਹ ਰਸੋਈ ਵਿੱਚ ਚੂਹੇ ਅਤੇ ਕਾਕਰੋਚਾਂ ਤੋਂ ਬਚਣ ਦੇ ਲਈ ਚੂਹਿਆਂ ਨੂੰ ਰੋਕਣ ਦੇ ਲਈ ਅਸੀਂ ਅੱਜ ਕੱਲ੍ਹ ਕੜਿੱਕੀ ਵਰਤਦੇ ਹਾਂ ਕੋਕਰੇਚ ਨੂੰ ਰੋਕਣ ਦੇ ਲਈ ਅਸੀਂ ਕਾਲਾ ਹਿੱਟ ਵਰਤਦੇ ਹਾਂ ਛਿਪਕਲੀਆਂ ਨੂੰ ਘਰਾਂ ਤੋਂ ਦੂਰ ਰੱਖਣ ਦੇ ਲਈ ਅਸੀਂ ਖੰਭਾਂ ਦੀ ਮੋਰ ਦੇ ਖੰਭਾਂ ਦੀ ਵਰਤੋਂ ਕਰਦੇ ਹਾਂ ਜਾਂ ਫਿਰ ਕੀੜੀਆਂ ਨੂੰ ਘਰਾਂ ਦੇ ਵਿੱਚੋਂ ਦੂਰ ਰੱਖਣ ਦੇ ਲਈ ਕ ਕੀੜੀਆਂ ਤੋਂ ਬਚਣ ਦੇ ਲਈ ਅਸੀਂ ਲਛਮਣ ਰੇਖਾ ਦੀ ਵਰਤੋਂ ਕਰਦੇ ਹਾਂ